ਹਾਈਕਿੰਗ ਕਰਦੇ ਸਮੇਂ ਕਈ ਦੁਰਘਟਨਾਵਾਂ ਹੋ ਜਾਂਦੀਆਂ ਹਨ ਇਸ ਲਈ ਫਸਟ ਏਡ ਕਿੱਟ ਬਹੁਤ ਜ਼ਰੂਰੀ ਹੈ ਅਤੇ ਫਸਟ ਏਡ ਕਿੱਟ ਵਿੱਚ ਕੁਝ ਜ਼ਰੂਰੀ ਚੀਜ਼ਾਂ ਹੋਣੀਆਂ ਚਾਹੀਦੀਆਂ ਹਨ ਜਿਵੇਂ ਥਰਮਾਮੀਟਰ ਮਾਸਕ ਐਂਟੀਸਪੇਟਿਕ ਕੁਝ ਪੱਟੀਆਂ ਬੈਂਡਏਜ ਸਰਿੰਜ ਐਂਟੀਬਾਇਓਟਿਕ ਬੀਟਾਡੀਨ ਪੇਨ ਕਿਲਰ ਅਤੇ ਮੂਵ ਅਜਿਹੀਆਂ ਚੀਜ਼ਾਂ ਫਸਟ ਏਡ ਕਿੱਟ ਵਿੱਚ ਬਹੁਤ ਜ਼ਰੂਰੀ ਹਨ ਅਤੇ ਅਸੀਂ ਇੱਕ ਵਾਰ ਹਾਈਕਿੰਗ ਕਰ ਰਹੇ ਸੀ ਤਾਂ ਮੇਰੇ ਨਾਲ ਦੇ ਦੋਸਤ ਨੂੰ ਸੱਟ ਲੱਗ ਗਈ ਸੀ ਇਸ ਲਈ ਅਸੀਂ ਪਹਿਲਾਂ ਡਿਟੋਲ ਨਾਲ ਸਾਫ ਕੀਤਾ ਡਿਟੋਲ ਐਂਟੀਸਪੇਟਿੰਗ ਨਾਲ ਅਤੇ ਉਸ ਤੋਂ ਬਾਅਦ ਉਸ ਉੱਪਰ ਬੀਟਾਡੀਨ ਲਗਾ ਕੇ ਉਸ ਉੱਪਰ ਪੱਟੀ ਕਰ ਦਿੱਤੀ